ਸ਼ਹੀਦ ਭਗਤ ਸਿੰਘ ਨਗਰ ਵਿੱਚ ਬਹੁਤ ਸਾਰੇ ਰਿਹਾਇਸ਼ੀ ਵਿਕਲਪ ਉਪਲਬਧ ਹੈਗੇ ਹੈ ਜਿੱਦਾਂ ਮੰਨ ਲਓ ਉਹ ਵੀ ਬੰਦਾ ਆਪਣੇ ਮਤਲਬ ਪੈਸੇ ਦੇ ਅਕੋਡਿੰਗ ਜੇਬ ਦੇ ਅਕੋਡਿੰਗ ਅਫੋਡ ਕਰ ਸਕਦਾ ਹੈਗਾ ਹੈ ਜਿੱਦਾਂ ਹੁਣ ਮੰਨ ਲਓ ਇੱਥੇ ਇੱਕ ਬਹੁਤ ਸਾਰੇ ਬੱਚੇ ਜਿੱਥੇ ਸਿੱਖਿਆ ਵਾਸਤੇ ਆਉਂਦੇ ਹੈਗੇ ਜਿਹਦਾ ਸਿੱਖਿਆ ਵਾਸਤੇ ਇੱਥੇ ਸਾਡੇ ਲੈਮਰਿਨ ਟੈਕ ਯੂਨੀਵਰਸਿਟੀ ਹੈਗੀ ਹੈ ਜਿਹੜੀ ਆਹ ਉੱਥੇ ਬਲਾਚੌਰ ਤੋਂ ਥੋੜ੍ਹੀ ਦੂਰ ਹੈਗੀ ਹੈ ਰੋਪੜ ਵੱਲ ਜਾਂਦਿਆਂ ਨੂੰ ਹੈਗੀ ਹੈ ਨਵਾਂ ਸ਼ਹਿਰ ਜਿਲ੍ਹੇ 'ਚ ਪੈਂਦੀ ਹੈ ਇਹਤੇ ਇਲਾਵਾ ਹੋਰ ਵੀ ਹੈਗੇ ਹੈ ਇੱਥੇ ਤਰ੍ਹਾਂ ਤਰ੍ਹਾਂ ਦੇ ਰੁਜ਼ਗਾਰ ਦੇ ਸਾਧਨ ਵੀ ਹੈਗੇ ਜਿੱਦਾਂ ਮੂਰਤੀਕਾਰਾਂ ਵਾਸਤੇ ਪ੍ਰਸਿੱਧ ਹੈਗਾ ਹੈ ਨਵਾਂਸ਼ਹਿਰ ਜਿਲ੍ਹਾ ਇਹਦੇ ਵਾਸਤੇ ਜਿਹੜੇ ਇੱਥੇ ਲੋਕ ਆਉਂਦੇ ਹੈਗੇ ਹੈ ਉਹ ਆਪਣੇ ਪੈਸੇ ਦੇ ਅਕੋਡਿੰਗ ਘਰ ਕਿਰਾਏ 'ਤੇ ਲੈਂਦੇ ਹੈਗੇ ਹੈ ਜਿੱਦਾਂ ਹੁਣ ਜਿਹਨਾਂ ਕੋਲ ਜ਼ਿਆਦਾ ਪੈਸਾ ਹੈਗਾ ਅਗਲੇ ਕੋਠੀ ਵੀ ਕਿਰਾਏ 'ਤੇ ਲੈ ਲੈਂਦੇ ਹੈਗੇ ਹੈ ਜਿਹਨਾਂ ਕੋਲ ਘੱਟ ਪੈਸਾ ਹੈਗਾ ਹੈ ਉਹ ਅਗਲੇ ਉਨਾ ਛੋਟਾ ਘਰ ਕਿਰਾਏ 'ਤੇ ਲੈ ਲੈਂਦੇ ਹੈਗੇ ਹੈ ਜਿਹੜੇ ਜਿੱਦਾਂ ਹੁਣ ਮੰਨ ਲਓ ਕੋਈ ਵੀ ਹੈਗਾ ਜਿੱਦਾਂ ਕੋਈ ਵੀ ਬਾਹਰੋਂ ਆਉਂਦਾ ਹੈਗਾ ਹੈ ਉਹ ਉੱਥੇ ਦੀ ਜਿਹੜੀ ਸਥਾਨਕ ਜਿਹੜਾ ਉੱਥੇ ਦਾ ਉਹ ਹੁੰਦਾ ਹੈਗਾ ਹੈ ਮਤਲਬ ਆਰਥਿਕਤਾ ਹੁੰਦੀ ਹੈਗੀ ਉਹਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਹੈਗਾ ਹੈ ਕਿਉਂਕਿ ਉੱਥੇ ਨੂੰ ਅਗਲੇ ਨੇ ਪੈਸਾ ਕਮਾਉਣਾ ਵੀ ਹੈਗਾ ਅਤੇ ਪੈਸਾ ਖਰਚਣਾ ਵੀ ਹੈਗਾ ਉੱਥੇ ਦਾ ਜਿਹੜਾ ਉਹ ਮਤਲਬ ਜਿੰਨਾ ਉੱਥੇ ਪੈਸਾ ਕਮਾਉਂਦਾ ਉਹ ਲਗਭਗ ਉਹਦਾ ਫਿਫਟੀ ਪ੍ਰਸੈਂਟ ਦੇ ਕਰੀਬ ਪੈਸਾ ਉੱਥੇ ਜਿਹੜੀਆਂ ਸਥਾਨਕ ਦੀਆਂ ਚੀਜ਼ਾਂ ਖਰੀਦਣ ਵਾਸਤੇ ਜਾਂ ਹੋਰ ਉੱਥੇ ਦੇ ਵਧੀਆ ਵਧੀਆ ਸ਼ੋਪਿੰਗ ਕਰਨ ਵਾਸਤੇ ਉਹਦਾ ਬਹੁਤ ਜ਼ਿਆਦਾ ਪੈਸਾ ਉਹਦੇ ਵਾਸਤੇ ਖਰਚ ਹੋ ਜਾਂਦਾ ਇਸ ਤਰ੍ਹਾਂ ਦੇਖ ਸਕਦੇ ਹੈਗੇ ਹੈ ਜਿਹੜੇ ਇੱਥੇ ਦੇ ਰਿਹਾਇਸ਼ੀ ਵਿਕਲਪ ਹੈਗੇ ਹੈ ਇੱਥੇ ਦਾ ਜਿਹੜਾ ਨਵਾਂਸ਼ਹਿਰ ਜਿਲ੍ਹੇ ਦਾ ਆਰਥਿਕ ਪੱਧਰ ਹੈਗਾ ਹੈ ਉਹਨੂੰ ਵੀ ਕਾਫੀ ਜ਼ਿਆਦਾ ਉੱਪਰ ਚੱਕਣ ਵਿੱਚ ਮਦਦ ਕਰਦਾ ਹੈਗਾ ਹੈ